ਘਰ ਦੇ ਵਿੱਚ ਖਾਣਾ ਬਣਾਉਣ ਤੋਂ ਪਹਿਲਾਂ ਮੈਂ ਇਸ ਦੀ ਤਿਆਰੀ ਸ਼ੁਰੂ ਕਰ ਦਿੰਦੀ ਹਾਂ ਪਹਿਲਾਂ ਤਾਂ ਮੈਂ ਜਿਹੜੀਆਂ ਆਪਣੇ ਕੋਲ ਸਬਜ਼ੀਆਂ ਨੇ ਉਹਨਾਂ ਨੂੰ ਕੱਟ ਕੇ ਰੱਖਦੀ ਹਾਂ ਸਬਜ਼ੀਆਂ ਨੂੰ ਕੱਟਣ ਤੋਂ ਬਾਅਦ ਮੈਂ ਉਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਜਿਹੜੀਆਂ ਵੀ ਧੋਣ ਵਾਲੀਆਂ ਪਹਿਲਾਂ ਧੋਣ ਵਾਲੀਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਪਹਿਲਾਂ ਧੋ ਲੈਂਦੀ ਹਾਂ ਜਿਵੇਂ ਕੋਈ ਕੁਛ ਸਬਜ਼ੀਆਂ ਆਪਾਂ ਕੱਟ ਕੇ ਧੋਂਦੇ ਹਾਂ ਤਾਂ ਉਹਨਾਂ ਨੂੰ ਕੱਟ ਕੇ ਵੀ ਧੋਂਦੀ ਹਾਂ ਫਿਰ ਮੈਂ ਉਹਨਾਂ ਨੂੰ ਕੱਟਣ ਤੋਂ ਬਾਅਦ ਉਹਨਾਂ ਨੂੰ ਰੱਖ ਦਿੰਦੀ ਹਾਂ ਇੱਕ ਸਾਈਡ 'ਤੇ ਰੱਖ ਦਿੰਦੀ ਹਾਂ ਉਸ ਤੋਂ ਬਾਅਦ ਮੈਂ ਮਸਾਲੇ ਤਿਆਰ ਕਰਦੀ ਹਾਂ ਮਸਾਲੇ ਤਿਆਰ ਕਰਨ ਲੱਗਿਆਂ ਮੈਂ ਸਭ ਤੋਂ ਪਹਿਲਾਂ ਪਿਆਜ ਕੱਟਦੀ ਹਾਂ ਪਿਆਜ ਅਤੇ ਟਮਾਟਰ ਕੱਟਦੀ ਹਾਂ ਉਹ ਕੱਟਣ ਤੋਂ ਬਾਅਦ ਮੈਂ ਸਰ੍ਹੋਂ ਦਾ ਤੇਲ ਹਮੇਸ਼ਾ ਵਰਤਦੀ ਹਾਂ ਸਰ੍ਹੋਂ ਦੇ ਤੇਲ ਨੂੰ ਮੈਂ ਪਹਿਲਾਂ ਗਰਮ ਕਰ ਦਿੰਦੀ ਹਾਂ ਜਦੋਂ ਉਹਦੇ ਵਿੱਚੋਂ ਧੂੰਆਂ ਨਿਕਲ ਜਾਂਦਾ ਹੈ ਫਿਰ ਮੈਂ ਬੰਦ ਕਰ ਦਿੰਦੀ ਹਾਂ ਬੰਦ ਕਰਨ ਤੋਂ ਬਾਅਦ ਮੈਂ ਗੈਸ ਬੰਦ ਕਰਨ ਤੋਂ ਬਾਅਦ ਮੈਂ ਹੋਰ ਜਿਹੜੇ ਮਸਾਲੇ ਤਿਆਰ ਕਰਨੇ ਹੁੰਦੇ ਹਨ ਜਿਵੇਂ ਕਿ ਲਸਣ ਹੈ ਅਦਰਕ ਹੈ ਜਾਂ ਹੋਰ ਸੁੱਕੇ ਮਸਾਲੇ ਜਿਹੜੇ ਨੇ ਇੱਕ ਪਾਸੇ ਕੱਟ ਕੇ ਉਹਨਾਂ ਨੂੰ ਕੁੱਟ ਕੇ ਕੁੰਡੇ ਸੋਟੇ ਦੇ ਵਿੱਚ ਮੈਂ ਕੁੱਟਦੀ ਹਾਂ ਉਹ ਕੁੱਟਣ ਤੋਂ ਬਾਅਦ ਮੈਂ ਰੱਖ ਦਿੰਦੀ ਹਾਂ ਉਹ ਰੱਖਣ ਤੋਂ ਬਾਅਦ ਮੈਂ ਫਿਰ ਦੁਬਾਰਾ ਗੈਸ ਔਨ ਕਰਕੇ ਉਸ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਆਪਣੇ ਮਸਾਲੇ ਨੇ ਪਿਆਜ ਟਮਾਟਰ ਲਸਣ ਅਦਰਕ ਪਾ ਕੇ ਇਹਨਾਂ ਨੂੰ ਫਰਾਈ ਕਰਦੀ ਹਾਂ ਫਰਾਈ ਕਰਨ ਤੋਂ ਬਾਅਦ ਮੈਂ ਉਹਦੇ ਵਿੱਚ ਸਬਜ਼ੀ ਪਾ ਦਿੰਦੀ ਹਾਂ ਇਸ ਤਰ੍ਹਾਂ ਜੇ ਮੈਂ ਪਹਿਲਾਂ ਉਹਦੀ ਤਿਆਰੀ ਕਰਕੇ ਰੱਖੀ ਹੁੰਦੀ ਹੈ ਤਾਂ ਇਹ ਸਬਜ਼ੀ ਬਣਾਉਣ ਦੇ ਵਿੱਚ ਮੈਨੂੰ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਹੈ ਮੈਂ ਇਹ ਕੰਮ ਕਰਨ ਲੱਗਿਆਂ ਕਿਸੇ ਨਾ ਕਿਸੇ ਦੀ ਮਦਦ ਵੀ ਜ਼ਰੂਰ ਲੈ ਲੈਂਦੀ ਹਾਂ ਜਿਵੇਂ ਕਿ ਮੈਂ ਆਪਣੀ ਬੇਟੀ ਨੂੰ ਵੀ ਬਹੁਤ ਵਾਰੀ ਕਹਿ ਦਿੰਦੀ ਹਾਂ ਕਿ ਮੇਰੇ ਕੋਲ ਆ ਜਾ ਅਤੇ ਥੋੜ੍ਹੀ ਜਿਹੀ ਮੇਰੀ ਹੈਲਪ ਕਰ ਦੇ ਤਾਂ ਇਸ ਤਰ੍ਹਾਂ ਅਸੀਂ ਸ ਸਾਰੇ ਮਿਲ ਕੇ ਸਬਜ਼ੀਆਂ ਬਣਾ ਲੈਂਦੇ ਹਾਂ